ਸਾਡੇ ਖੇਤਰ ਵਿੱਚ ਕਈ ਇਹੋ ਜਿਹੀਆਂ ਥਾਵਾਂ ਹਨ ਜਿੱਥੇ ਤਰ੍ਹਾਂ ਤਰ੍ਹਾਂ ਦੇ ਪੰਛੀ ਦੇਖੇ ਜਾ ਸਕਦੇ ਹਨ ਜਿਸ ਤਰ੍ਹਾਂ ਨਿੱਕੂ ਪਾਰਕ ਵਿੱਚ ਦੇ ਨਿੱਕੂ ਪਾਰਕ ਵਿੱਚ ਜਾਓ ਉੱਥੇ ਕਬੂਤਰ ਵੀ ਰੱਖੇ ਹੋਏ ਹਨ ਅਤੇ ਬੱਤਖਾਂ ਵੀ ਨੇ ਪਰ ਸਾਡੇ ਆਸੇ ਪਾਸੇ ਖੇਤ ਖੇਤ ਨੇ ਜਿੱਥੇ ਅ ਖਾਲੀ ਪਲਾਟ ਨੇ ਜਿੱਥੇ ਕਬੂਤਰ ਬਹੁਤ ਆਉਂਦੇ ਹਨ ਕਬੂਤਰ ਅਤੇ ਚਿੜੀਆਂ ਤੋਤੇ ਵੀ ਆਉਂਦੇ ਹਨ ਪਰ ਸ ਜੇ ਜ਼ਿਆਦਾ ਮਾਤਰਾ ਵਿੱਚ ਦਾਣੇ ਪਾ ਕੇ ਖੇਤਾਂ ਵਿੱਚ ਪੰਛੀ ਦੇਖੇ ਜਾ ਸਕਦੇ ਹਨ ਸ਼ਹਿਰਾਂ ਵਿੱਚ ਪੰਛੀ ਘੱਟ ਹੁੰਦੇ ਹਨ ਸਾਡਾ ਤਾਂ ਅਸੀਂ ਖੇਤਰ ਵੀ ਅਸੀਂ ਬਾਹਰ ਵਾਲੇ ਖੇਤਰ ਵਿੱਚ ਰਹਿੰਦੇ ਹਾਂ ਜਿੱਥੇ ਆਸ ਪਾਸ ਖੇਤ ਹੀ ਖੇਤ ਹਨ ਅਤੇ ਖੇਤਾਂ ਵਿੱਚ ਪੰਛੀ ਦਾਣਾ ਚੁਗਣ ਵਾਸਤੇ ਆਉਂਦੇ ਹਨ ਉੱਥੇ ਜ਼ਿਆਦਾਤਰ ਅਸੀਂ ਚਿੜੀਆਂ ਤੋਤੇ ਕਬੂਤਰ ਆਦਿ ਹੀ ਦੇਖੇ ਦੇਖਦੇ ਹਾਂ ਹੋਰ ਜ਼ਿਆਦਾ ਜ਼ਿਆਦਾ ਸਾਨੂੰ ਇਹ ਵੀ ਦੇਖੇ ਜਾਂਦੇ ਹਨ ਪੰਛੀ ਕਿ ਜਦੋਂ ਪਾਣੀ ਕੋਠਿਆਂ ਦੇ ਉੱਤੇ ਪਾਣੀ ਰੱਖਦੇ ਹਾਂ ਤਾਂ ਉੱਥੇ ਵੀ ਹਰ ਤਰ੍ਹਾਂ ਦੇ ਪੰਛੀ ਆ ਪਾਣੀ ਪੀਣ ਵਾਸਤੇ ਆ ਜਾਂਦੇ ਹਨ ਸਾਡੇ ਘਰ ਕੋਲ ਇੱਕ ਛੋਟਾ ਜਿਹਾ ਐਸਾ ਬਣਿਆ ਹੋਇਆ ਹੈ ਜਿੱਥੇ ਪੰਛੀ ਸਾਰੇ ਪੰਛੀ ਇਕੱਠੇ ਹੋ ਕੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਪੰਛੀਆਂ ਦੀ ਦੇਖ ਭਾਲ ਕੀਤੀ ਜਾਂਦੀ ਹੈ ਪੰਛੀ ਦੀ ਦੇਖ ਭਾਲ ਕਰਨ ਲਈ ਵੀ ਬੰਦੇ ਰੱਖੇ ਹੋਏ ਹਨ ਪੰਛੀਆਂ ਨੂੰ ਤਰ੍ਹਾਂ ਤਰ੍ਹਾਂ ਦਾ ਦਾਣਾ ਪਾਇਆ ਜਾਂਦਾ ਹੈ ਅਤੇ ਪੰਛੀਆਂ ਨੂੰ ਇੱਕ ਪਿੰਜਰੇ ਤੋਂ ਬਾਹਰ ਖੁੱਲ੍ਹੇ ਅਜ਼ਾਦ ਵਿੱਚ ਉਡਾਇਆ ਜਾਂਦਾ ਹੈ ਉਹ ਸਵੇਰੇ ਸ਼ਾਮ ਨੂੰ ਪੰਛੀ ਆਉਂਦੇ ਹਨ ਉੱਥੋਂ ਦਾ ਨਜ਼ਾਰਾ ਪੰਛੀਆਂ ਨੂੰ ਦੇਖ ਕੇ ਬੜਾ ਵਧੀਆ ਲੱਗਦਾ ਹੈ ਥੈ ਧੰਨਵਾਦ